ਵੈਸੇ ਤਾਂ ਮੈਨੇ ਕੋਈ ਵੀ ਫੋਟੋਗਰਾਫੀ ਵਰਕਸ਼ਾਪ ਵਿੱਚ ਹਿੱਸਾ ਨਹੀਂ ਲਿਆ ਪਰ ਮੈਨੂੰ ਫੋਟੋਗਰਾਫੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਇਸ ਲਈ ਮੈਂ ਆਪਣੇ ਫੋਨ ਵਿੱਚ ਹੀ ਫੋਟੋਆਂ ਕਰਦਾ ਰਹਿੰਦਾ ਹਾਂ ਜੋ ਵੀ ਚੀਜ਼ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਮੈਂ ਉਸ ਦੀਆਂ ਫੋਟੋਆਂ ਖਿੱਚ ਲੈਂਦਾ ਹਾਂ ਜਿਵੇਂ ਕਿ ਕੋਈ ਵੀ ਫੁੱਲ ਜਾਂ ਸੱਥ ਵਿੱਚ ਬੈਠੇ ਬੰਦੇ ਜਾਂ ਪਹਾੜਾਂ ਦੀਆਂ ਇੱਦਾਂ ਦੀਆਂ ਤਸਵੀਰਾਂ ਕਰਦਾ ਰਹਿਣਾ ਹਾਂ ਜੋ ਕਿ ਮੈਨੂੰ ਕੁਦਰਤ ਨਾਲ ਜੋੜਦੀਆਂ ਹਨ ਮੈਨੂੰ ਪੰਛੀਆਂ ਦੀਆਂ ਤਸਵੀਰਾਂ ਲੈਣੀਆਂ ਅਤੇ ਪਹਾੜਾਂ ਵਿੱਚ ਜਾ ਕੇ ਪਹਾੜਾਂ ਦੀਆਂ ਤਸਵੀਰਾਂ ਲੈਣੀਆਂ ਅਤੇ ਆਪਣੀਆਂ ਅਤੇ ਹੋਰ ਆਪਣੇ ਦੋਸਤਾਂ ਦੀਆਂ ਤਸਵੀਰਾਂ ਲੈਣੀਆਂ ਬਹੁਤ ਚੰਗੀਆਂ ਲੱਗਦਾ ਹੈ ਅਤੇ ਤਸਵੀਰ ਲੈਣ ਲਈ ਹੁਣ ਮੈਨੇ ਆਪਣੇ ਕੋਲ ਇੱਕ ਛੋਟਾ ਡਿਜੀਟਲ ਕੈਮਰੇ ਵਾਲਾ ਡਿਜੀਟਲ ਕੈਮਰਾ ਲੈ ਲਿਆ ਹੈ ਜਿਸ ਨਾਲ ਮੈਂ ਹੁਣ ਤਸਵੀਰਾਂ ਕਰਦਾ ਰਹਿੰਦਾ ਹਾਂ